ਸਾਡਾ ਪੰਜਾਬ ਰਾਜ ਦਾ ਮੁੱਖ ਕਿੱਤਾ ਖੇਤੀਬਾੜੀ ਆ ਮੈਂ ਪੇਂਡੂ ਖੇਤਰ ਵਿੱਚ ਰਹਿੰਦੀ ਹਾਂ ਜਿਸ ਤਰ੍ਹਾਂ ਉੱਥੇ ਪਸ਼ੂ ਪਾਲਣ ਮੱਛੀ ਪਾਲਣ ਵਪਾਰ ਕੀਤਾ ਜਾਂਦਾ ਹੈ ਪਰ ਸਾਡਾ ਜ਼ਿਆਦਾਤਰ ਜਿਹੜਾ ਸਾਡਾ ਰੁਜ਼ਗਾਰ ਆ ਸਾਡਾ ਕੰਮ ਆ ਉਹ ਅਸੀਂ ਖੇਤੀਬਾੜੀ ਲਈ ਕਰਦੇ ਹਾਂ ਖੇਤੀਬਾੜੀ 'ਤੇ ਹੀ ਨਿਰਭਰ ਕਰਦਾ ਵਾ ਖੇਤੀਬਾੜੀ ਲਈ ਵੀ ਸਾਨੂੰ ਪਾਣੀ ਦੀ ਬਹੁਤ ਜ਼ਰੂਰਤ ਪੈਂਦੀ ਹੈ ਜਿੱਦਾਂ ਪਾਣੀ ਕਈ ਸਰੋਤ ਹਨ ਜਿਵੇਂ ਕਿ ਨਹਿਰਾਂ ਦਾ ਪਾਣੀ ਸਾਡੇ ਪੰਜਾਬ ਵਿੱਚ ਦਰਿਆਵਾਂ ਦਰਿਆ ਵੀ ਹਨ ਉਹਨਾਂ ਦਰਿਆਵਾਂ ਦਾ ਪਾਣੀ ਜਿਹੜਾ ਵਾ ਉਹ ਸਾਡੀ ਨਹਿਰਾਂ ਰਾਹੀਂ ਨਹਿਰਾਂ ਰਾਹੀਂ ਸਾਡੇ ਹਰ ਖੇਤਰ ਹਰ ਪਿੰਡ ਹਰ ਪੈਲੀ ਵਿੱਚ ਪਹੁੰਚਾਇਆ ਜਾਂਦਾ ਸਾਡੀ ਜ਼ਮੀਨ ਦੇ ਕੋਲ ਜਿਸ ਤਰ੍ਹਾਂ ਨਹਿਰਾਂ ਦੇ ਵਿੱਚੋਂ ਇੱਕ ਪਾਣੀ ਪੈਲੀਆਂ ਤੱਕ ਖੇਤਾਂ ਤੱਕ ਪਹੁੰਚਾਉਣ ਲਈ ਨਹਿਰਾਂ ਤੋਂ ਛੋਟੇ ਛੋਟੇ ਅੱਗੇ ਸੂਏ ਵੀ ਬਣਾਏ ਗਏ ਨੇ ਉਹਨਾਂ ਰਾਹੀਂ ਵੀ ਪਾਣੀ ਪਹੁੰਚਾਇਆ ਜਾਂਦਾ ਵਾ ਸਾਡੇ ਟਿਊਬਵੈੱਲ ਵੀ ਹੈਗੇ ਆ ਜਿਹਨਾਂ ਦੇ ਟਿਊਬ ਲੈਨਾਂ ਰਾਹੀਂ ਵੀ ਖੇਤੀ ਨੂੰ ਪਾਣੀ ਦਿੱਤਾ ਜਾਂਦਾ ਵਾ ਜਿਸ ਤਰ੍ਹਾਂ ਉਹ ਬਿਜਲੀ ਰਾਹੀਂ ਚੱਲਦੇ ਆ ਬਿਜਲੀ ਰਾਹੀਂ ਟਿਊਬਵੈੱਲ ਚਲਾਏ ਜਾਂਦੇ ਅਤੇ ਉਹਨਾਂ ਦਾ ਪਾਣੀ ਜਿਹੜਾ ਵਾ ਉਹ ਖੇਤਾਂ ਤੱਕ ਪਹੁੰਚਾਇਆ ਜਾਂਦਾ ਵਾ ਜ਼ਮੀਨ ਤੱਕ ਪਹੁੰਚਾਇਆ ਜਾਂਦਾ ਘਰਾਂ ਦਾ ਪਾਣੀ ਜਿਹੜਾ ਸਾਡਾ ਵਾਧੂ ਵੇਸਟ ਪਾਣੀ ਹੁੰਦਾ ਵਾ ਉਹ ਵੀ ਅਸੀਂ ਜਿਹੜਾ ਵਾ ਫਸਲਾਂ ਤੱਕ ਪਹੁੰਚਾਉਂਦੇ ਹਾਂ ਵੀ ਉਹ ਸਾਡੀ ਫਸਲਾਂ ਦੇ ਕੰਮ ਆ ਸਕੇ ਵੇਸਟ ਨਾ ਜਾਵੇ ਜਿੱਦਾਂ ਹੁਣ ਸਾਡੇ ਪਿੰਡ ਵਿੱਚ ਛੱਪੜ ਬਣਾਏ ਆ ਸਾਡੇ ਪਿੰਡ ਵਿੱਚ ਛੱਪੜ ਬਣਿਆ ਹੋਇਆ ਵਾ ਉਹਦੇ ਵਿੱਚ ਮੀਂਹ ਦਾ ਪਾਣੀ ਸਾਰਾ ਜਮ੍ਹਾਂ ਕੀਤਾ ਜਾਂਦਾ ਹੈ ਘਰਾਂ ਦਾ ਜਿਹੜਾ ਪਾਣੀ ਜਾਂਦਾ ਉਹ ਵੀ ਜਮ੍ਹਾਂ ਕੀਤਾ ਜਾਂਦਾ ਹੈ ਫਿਰ ਉਹ ਪਾਣੀ ਨੂੰ ਜਿਸ ਤਰ੍ਹਾਂ ਕਿ ਟੈਂਕਰਾਂ ਰਾਹੀਂ ਜਾਂ ਪਾਈਪਾਂ ਰਾਹੀਂ ਖੜ੍ਹ ਕੇ ਖਾਲੀਆਂ ਰਾਹੀਂ ਖੜ੍ਹ ਕੇ ਪਾਣੀ ਨੂੰ ਪੈਲੀਆਂ ਤੱਕ ਖੇਤਾਂ ਤੱਕ ਪਹੁੰਚਾਇਆ ਜਾਂਦਾ ਵਾ ਹੋਰ ਜਿੱਦਾਂ ਸਰਕਾਰ ਨੇ ਵੀ ਜਿਵੇਂ ਪਾਣੀ ਦੇ ਸਰਕਾਰ ਨੇ ਪਾਣੀ ਜਿੱਦਾਂ ਵੀ ਪਾਣੀ ਨਹੀਂ ਵੀ ਆ ਉੱਥੇ ਵੀ ਜਿੱਥੇ ਪਾਣੀ ਨਹੀਂ ਜਿਹੜੀ ਪੈਲੀ ਤੱਕ ਪਾਣੀ ਨਹੀਂ ਪਹੁੰਚ ਸਕਦਾ ਜਿਹੜੇ ਖੇਤਾਂ ਤੱਕ ਪਾਣੀ ਨਹੀਂ ਪਹੁੰਚਿਆ ਉੱਥੇ ਵੀ ਸਰਕਾਰ ਨੇ ਪਾਣੀ ਪਹੁੰਚਾਇਆ ਵਾ ਜਿੱਦਾਂ ਕਿ ਹੁਣ ਪਾਈਪਾਂ ਰਾਹੀਂ ਪਾਈਪਾਂ ਪਾ ਕੇ ਉਹਨਾਂ ਨੂੰ ਪਾਣੀ ਪਹੁੰਚਾ ਕੇ ਉਹ ਪੈਲੀ ਤੱਕ ਉਹ ਪੈਲੀ ਨੂੰ ਕਾਬਲੀਅਤ ਲਈ ਬਣਾਇਆ ਗਿਆ ਵਾ ਕੀ ਉਹ ਪੈਲੀ ਵਿੱਚ ਕੁਛ ਜ਼ਮੀਨ 'ਚ ਕੁਛ ਹੋ ਸਕੇ ਹੁਣ ਜਿੱਦਾਂ ਹਾਂਜੀ ਜਿੱਦਾਂ ਜ਼ਮੀਨ ਨੂੰ ਸਿੰਜਿਆ ਜਾ ਰਿਹਾ ਵਾ ਤਾਂ ਇਸ ਕਰਕੇ ਪਾਣੀ ਜੋ ਆ ਪਾਣੀ ਸਾਡਾ ਜਿਹੜਾ ਹੇਠਾਂ ਜਾ ਰਿਹਾ ਵਾ ਉਹ ਪਾਣੀ ਨੂੰ ਬਚਾਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵਧੀਆ ਪਾਣੀ ਬਚਾ ਸਕੀਏ ਅਸੀਂ